ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਅੱਜ ਕਲਾ ਤਿਉਹਾਰਾਂ ਜਾਂ ਸਮਾਗਮਾਂ ਬਾਰੇ ਕੁਛ ਵਿਚਾਰ ਦੱਸ ਰਹੀ ਹਾਂ ਪੰਜਾਬ ਦੀ ਧਰਤੀ ਵੈਸੇ ਤਾਂ ਮੇਲਿਆਂ ਦੀ ਧਰਤੀ ਹੈ ਇੱਥੇ ਆਏ ਦਿਨ ਕੋਈ ਨਾ ਕੋਈ ਮੇਲੇ ਦਿਨ ਤਿਉਹਾਰ ਆਏ ਹੀ ਰਹਿੰਦੇ ਹਨ ਕੋਈ ਗੁਰਪੁਰਬ ਮਨਾਏ ਜਾਂਦੇ ਹਨ ਮੇਲੇ ਤਿਉਹਾਰ ਮਨਾਏ ਜਾਂਦੇ ਹਨ ਇਹਨਾਂ ਤਿਉਹਾਰਾਂ ਵਿੱਚ ਜਿਵੇਂ ਲੋਹੜੀ ਹੋਲੀ ਦਿਵਾਲੀ ਰੱਖੜੀ ਵਿਸਾਖੀ ਗੁਰਪੁਰਬ ਆਦਿ ਤਿਉਹਾਰ ਹਨ ਹਰ ਤਿਉਹਾਰ ਦਾ ਕਿਸੇ ਨਾ ਕਿਸੇ ਇਤਿਹਾਸਿਕ ਨਾਲ ਸੰਬੰਧ ਹੈ ਜਿਵੇਂ ਲੋਹੜੀ ਦਾ ਤਿਉਹਾਰ ਦੁੱਲੇ ਭੱਟੀ ਨਾਲ ਸੰਬੰਧ ਰੱਖਦਾ ਹੈ ਅਤੇ ਦੁੱਲੇ ਦੀ ਭੱ ਦੁਲੇ ਭੱਟੀ ਦੀ ਕਹਾਣੀ ਨੂੰ ਹਰ ਕੋਈ ਜਾਣਦਾ ਹੈ ਕਿ ਦੁੱਲਾ ਕੌਣ ਸੀ ਉਸ ਨੇ ਕਿੰਨੀਆਂ ਉਹਨਾਂ ਗਰੀਬ ਕੁੜੀਆਂ ਦਾ ਵਿਆਹ ਕੀਤਾ ਸੀ ਇਸੇ ਤਰ੍ਹਾਂ ਹੋਲੀ ਦਾ ਤਿਉਹਾਰ ਉਸ ਹੋਲੀਕਾ ਬਾਰੇ ਜਿਹੜੀ ਕਿ ਅੱਗ ਵਿੱਚ ਜਲ ਗਈ ਸੀ ਉਸ ਬਾਰੇ ਤੁਹਾਨੂੰ ਸਾਰਿਆਂ ਨੂੰ ਆਮ ਪਤਾ ਹੀ ਹੋਣਾ ਹੈ ਦਿਵਾਲੀ ਦਾ ਤਿਉਹਾਰ ਹੈ ਦਿਵਾਲੀ ਦੇ ਤਿਉਹਾਰ 'ਤੇ ਦੀਵਿਆਂ ਦਾ ਤਿਉਹਾਰ ਵੀ ਜਿਹਨੂੰ ਕਿਹਾ ਜਾਂਦਾ ਹੈ ਇਹ ਤਿਉਹਾਰ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਦਿਵਾਲੀ ਦਾ ਤਿਉਹਾਰ ਹਿੰਦੂਆਂ ਦੇ ਮਨਾਉਣ ਦਾ ਕਾਰਨ ਇਹ ਹੈ ਕਿ ਉਸ ਦਿਨ ਰਾਮ ਚੰਦਰ ਜੀ ਚੌਦ੍ਹਾਂ ਸਾਲ ਦਾ ਬਨਵਾਸ ਕੱਟ ਕੇ ਆਏ ਸਨ ਅਤੇ ਉਸੇ ਦਿਨ ਹੀ ਦਿਵਾਲੀ ਵਾਲੇ ਦਿਨ ਛੇਵੇਂ ਗੁਰੂ ਹਰਗੋਬਿੰਦ ਜੀ ਬਵੰਜਾ ਕਵੀਆਂ ਦੇ ਨਾਲ ਰਿਹਾਅ ਹੋ ਕੇ ਆਏ ਸਨ ਵਿਸਾਖੀ ਦਾ ਤਿਉਹਾਰ ਕਣਕ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਉਸ ਦਿਨ ਕਿਸਾਨ ਫਸਲਾਂ ਵੱਢ ਕੇ ਵਿਹਲੇ ਹੋ ਜਾਂਦੇ ਹਨ ਅਤੇ ਵਿਸਾਖੀ ਨਾਹੁਣ ਜਾਂਦੇ ਹਨ ਅਤੇ ਵਿਸਾਖੀ ਨੂੰ ਇੱਕ ਮੇਲੇ ਵਾਂਗੂੰ ਤਿਉਹਾਰ ਮਨਾਉਂਦੇ ਹਨ ਰੱਖੜੀ ਦਾ ਤਿਉਹਾਰ ਭੈਣ ਭਰਾਵਾਂ ਦੇ ਪਿਆਰ ਦਾ ਤਰੀਕ ਪ੍ਰਤੀਕ ਹੈ ਗੁਰਪੁਰਬ ਗੁਰੂਆਂ ਦੇ ਜਨਮ ਅਤੇ ਗੁਰੂਆਂ ਦੇ ਸਮਾ ਜਾਣ ਦੇ ਸੰਬੰਧ ਵਿੱਚ ਇਹ ਮਨਾਏ ਜਾਂਦੇ ਹਨ ਉਹਨਾਂ ਨੂੰ ਗੁਰਪੁਰਬ ਕਿਹਾ ਜਾਂਦਾ ਹੈ ਗੁਰੂਆਂ ਦੇ ਜਨਮ ਗੁਰਦੁਆਰਿਆਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਮਨਾਏ ਜਾਂਦੇ ਹਨ ਉਹਨਾਂ ਗੁਰੂਆਂ ਬਾਰੇ ਸਮਾਗਮ ਰੱਖੇ ਜਾਂਦੇ ਹਨ ਢਾਡੀ ਵਾਰਾਂ ਗਾਉਂਦੇ ਹਨ ਕਥਾਕਾਰ ਕਥਾਵਾਂ ਸਰਾਂ ਅਤੇ ਉਹਨਾਂ ਗੁਰੂਆਂ ਦੀਆਂ ਘਟ ਜੀਵਨਾਂ ਬਾਰੇ ਚਾਨਣਾ ਪਾਉਂਦੇ ਹਨ ਸਕੂਲੀ ਬੱਚੇ ਆਪਣੇ ਆਪਣੇ ਗਰੁੱਪ ਵਿੱਚ ਉਹਨਾਂ ਗੁਰੂਆਂ ਬਾਰੇ ਸ਼ਬਦ ਗਾਇਨ ਕਰਕੇ ਗੁਰੂ ਦੀ ਮਹਿਮਾ ਨੂੰ ਪ੍ਰਸ ਪ੍ਰਸਾਰਿਤ ਕਰਦੇ ਹਨ ਇਹ ਤਿਉਹਾਰ ਸਾਡੇ ਸਮਾਜ ਵਿੱਚ ਬਹੁਤ ਹੀ ਅਹਿਮ ਤਿਉਹਾਰ ਹੁੰਦਾ ਹੈ ਇਹਨਾਂ ਤਿਉਹਾਰਾਂ ਵਿੱਚ ਗੁਰਪੁਰਬ ਦੇ ਮੌਕੇ 'ਤੇ ਵਧੀਆ ਤੋਂ ਵਧੀਆ ਕਹਾਣੀਕਾਰ ਕ ਕਥਾਕਾਰਾਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਸੁਣਨ ਲਈ ਲੋਕ ਉਤਾਵਲੇ ਹੁੰਦੇ ਹਨ ਅਤੇ ਉਚੇਚੇ ਤੌਰ 'ਤੇ ਗੁਰਦੁਆਰੇ ਜਾ ਕੇ ਉਹਨਾਂ ਦੀ ਕਥਾ ਨੂੰ ਸੁਣਦੇ ਹਨ ਧੰਨਵਾਦ